ਕੰਟੇਨਰ ਬਾਗਵਾਨੀ ਤੇ ਅਸੀਂ ਤਕਰੀਬਨ ਕਰਦੇ ਰਹਿੰਦੇ ਹਾਂ ਕਿਉਂਕਿ ਜਿਸ ਤਰ੍ਹਾਂ ਆਪਾਂ ਘਰਾਂ ਦੇ ਵਿੱਚ ਕੁਕਿੰਗ ਆਇਲ ਲਿਆਉਂਦੇ ਹਾਂ ਉਹ ਕੰਟੇਨਰਾਂ ਦੇ ਵਿੱਚ ਆਉਂਦਾ ਜਿਹੜੇ ਪੰਜ ਲੀਟਰ ਦੇ ਹੁੰਦੇ ਆ ਅਤੇ ਜਦੋਂ ਕੰਟੇਨਰ ਫਿਰ ਖਾਲੀ ਹੋ ਜਾਂਦੇ ਆ ਤੇ ਉਨ੍ਹਾਂ ਨੂੰ ਓ ਕੱਟ ਕੇ ਅਤੇ ਉਨ੍ਹਾਂ ਦੇ ਵਿੱਚ ਮਿੱਟੀ ਪਾ ਕੇ ਛੇਦ ਕੱਢ ਕੇ ਅਤੇ ਫਿਰ ਮਿੱਟੀ ਪਾ ਕੇ ਤੇ ਆਪਾਂ ਉਨ੍ਹਾਂ ਦੇ ਵਿੱਚ ਅ ਬੂਟੇ ਵਗੈਰਾ ਲਾ ਲੈਂਦੇ ਹਾਂ ਪੌਦੇ ਲਾ ਲੈਂਦੇ ਆ ਉਹ ਫਿਰ ਇਸ ਤਰ੍ਹਾਂ ਹੀ ਕੰਟੇਨਰਾਂ ਦੀ ਜਿਹੜੀ ਬਾਗਬਾਨੀ ਕੀਤੀ ਬਾਕੀ ਦਾ ਲਾਂਭਕਾਰੀ ਜਿਹੜੀ ਆ ਉਹ ਪਾਈਪ ਦੇ ਵਿੱਚ ਤੇ ਅਸੀਂ ਨਹੀਂ ਕਦੀ ਅ ਵਰਤੋਂ ਕੀਤੀ ਜਾਂ ਬੂਟੇ ਲਾਉਣ ਦੀ ਕੋਸ਼ਿਸ਼ ਨਹੀਂ ਕੀਤੀ ਹੈਗੀ ਕੰਟੇਨਰ ਜਿਹੜੇ ਆ ਇਹ ਜ਼ਰੂਰ ਅਸੀਂ ਵਰਤੀ ਦੇ ਆ ਇਸ ਤਰ੍ਹਾਂ ਕਿਉਂਕਿ ਆਮ ਸਾਡੇ ਘਰਾਂ 'ਚ ਤੇਲ ਤੁਲ ਦੇ ਜਿਹੜੇ ਕੰਟੇਨਰ ਖਾਲੀ ਹੋਏ ਰਹਿੰਦੇ ਆ ਉਨ੍ਹਾਂ ਦੀ ਵਰਤੋਂ ਜ਼ਰੂਰ ਕਰੀਦੀ ਆ ਬੂਟੇ ਵਗੈਰਾ ਲਗਾਉਣ 'ਚ